ਹੈਲੋ ਹਾਂਜੀ ਸਾਸ਼ੀਕਾਲ ਜੀ ਹਾਂਜੀ ਸਾਸ਼ੀਕਾਲ ਜੀ ਹੋਰ ਕੀ ਹਾਲ ਚਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੰਜਾਬੀ ਸਿੰਗਰ ਨੂੰ ਹਾਂਜੀ ਹਾਂਜੀ ਮੈਂ ਪਿਯੂ ਮਿਊਜਿਕ ਟੀਚਰ ਹਾਂ ਹਾਂਜੀ ਹਾਂਜੀ ਇੱਥੇ ਫੇਮਸ ਪੰਜਾਬ ਦੇ ਕਾਫ਼ੀ ਨੇ ਲੇਕਿਨ ਉਹਨਾਂ ਚੋਂ ਮੋਸਟ ਜਿਹੜੇ ਕੁਝ ਅੱਛੇ ਨੇ ਉਹ ਗੁਰਦਾਸ ਮਾਨ ਜੀ ਨੇ ਲਖਵਿੰਦਰ ਵਡਾਲੀ ਜੀ ਨੇ ਸਰਤਾਜ ਸਤਿੰਦਰ ਸਰਤਾਜ ਸੁਣਿਆ ਹੀ ਹੋਏਗਾ ਤੁਸੀਂ ਅਤੇ ਹਾਂਜੀ ਹਾਂਜੀ ਉਹਨਾਂ ਦੀ ਸਿੰਗਿੰਗ ਕਾਫ਼ੀ ਅੱਛੀ ਹੈ ਸਾਡੇ ਕੁਝ ਨੋਨ 'ਚ ਵੀ ਨੇ ਅਸੀਂ ਰਿਸ਼ਤੇਦਾਰਾਂ ਮਤਲਬ ਕੋਈ ਫੰਕਸ਼ਨ ਵਗੈਰਾ ਪਾਰਟੀ ਹੁੰਦੀ ਅਤੇ ਅਸੀਂ ਉਹਨਾਂ ਨੂੰ ਵੀ ਇੰਨਵਾਈਟ ਵੀ ਕਰਦੇ ਰਹਿੰਦੇ ਵੈਸੇ ਪੇਮੈਂਟ ਉਹਨਾਂ ਦੀ ਵੈਸੇ ਤਾਂ ਉਹਨਾਂ ਦੀ ਪੇਮੈਂਟ ਢਾਈ ਤਿੰਨ ਲੱਖ ਰੁਪਏ ਦੇ ਰਾਊਂਡ ਹੁੰਦੀ ਹੈ ਬਟ ਸਾਡੇ ਥੋੜ੍ਹੇ ਰਿਲੇਸ਼ਨ ਅੱਛੇ ਨੇ ਇਸ ਲਈ ਸਾਡੇ ਕੋਲੋਂ ਫਿਰ ਵੀ ਨੋਰਮਲ ਰੇਂਜ ਲੈ ਲੈਂਦੇ ਨੇ ਹਾਂਜੀ ਹਾਂਜੀ ਹਾਂਜੀ ਕਰਵਾ ਸਕਦੇ ਹਾਂ ਕਰਵਾ ਦਾਂਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਸਲੈਕਟ ਕਰ ਲਓ ਕਿ ਕਿਹਨੂੰ ਕਰਵਾਉਣਾ ਲਖਵਿੰਦਰ ਵਡਾਲੀ ਨੂੰ ਸਰਤਾਜ ਨੂੰ ਜਾਂ ਫਿਰ ਤੁਸੀਂ ਗੁਰਦਾਸ ਮਾਨ ਨੂੰ ਗੁਰ ਗੁਰਦਾਸ ਮਾਨ ਦੀ ਪੇਮੈਂਟ ਥੋੜ੍ਹੀ ਜ਼ਿਆਦਾ ਹੁੰਦੀ ਹੈ ਤੁਸੀਂ ਆਪਣੇ ਅ ਘਰ ਸਲਾਹ ਕਰ ਲਓ ਗੱਲ ਕਰ ਲਓ ਹਾਂਜੀ ਅਤੇ ਫਿਰ ਤੁਸੀਂ ਘਰ ਦੇ ਫੰਕਸ਼ਨ ਘਰ 'ਚ ਈ ਰੱਖਿਆ ਹੋਇਆ ਕਿ ਬਾਹਰ ਕਿਤੇ ਰੱਖਿਆ ਹੋਇਆ ਅੱਛਾ ਜੀ ਠੀਕ ਹੈ ਮੈਰਿਜ ਫੰਕਸ਼ਨ ਪਾਰਟੀ ਹੈ ਕੋਈ ਅੱਛਾ ਜੀ ਠੀਕ ਹੈ ਹਾਂਜੀ ਉੱਥੇ ਤਾਂ ਵਧੀਆ ਫਿਰ ਅਰੇਂਜਮੈਂਟ ਹੋ ਜਾਂਦਾ ਉਹਨਾਂ ਦਾ ਉਹਨਾਂ ਨੇ ਟਾਈਮ ਵੀ ਲੈਣਾ ਹੁੰਦਾ ਆਪਣਾ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਹਾਂ ਤੁਸੀਂ ਕਰ ਲਓ ਗੱਲ ਕੋਈ ਨੀ ਜਿੰਨਾ ਹੋਏਗਾ ਵੱਧ ਤੋਂ ਵੱਧ ਜਿੰਨਾ ਲੈਸ ਹੋ ਸਕੇਗਾ ਕਰਵਾ ਦਾਂਗੇ ਠੀਕ ਹੈ ਜੀ ਓਕੇ ਜੀ ਓਕੇ